ਪੌਦਿਆਂ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਨਰਸਰੀ ਤਿਆਰ ਕਰਨੀ ਚਾਹੀਦੀ ਵੀ ਆਪਾਂ ਨੇ ਕਿਹੜੇ ਪੌਦੇ ਲਾਉਣੇ ਹੈ ਕਿਸ ਮੌਸਮ 'ਚ ਲਾਉਣੇ ਹੈ ਅਤੇ ਦੂਜੀ ਗੱਲ ਇੱਦਾਂ ਇਹ ਹੈ ਵੀ ਮੌਸਮ ਸਭ ਤੋਂ ਵਧੀਆ ਮੌਸਮ ਇਨ੍ਹਾਂ ਲਈ ਲਾਉਣ ਦਾ ਬਰਸਾਤ ਤੋਂ ਪਹਿਲਾਂ ਇਸ 'ਚ ਨਾ ਬੂਟਾ ਪਕੜ ਕਰਦਾ ਹੈ ਜਿਸ ਨਾਲ ਨਾ ਬਰਸਾਤ ਪੈਂਦੀ ਹੈ ਬ ਬੂਟਾ ਜੜ੍ਹ ਫੜ ਫੜ ਲੈਂਦਾ ਹੈ ਉਸ ਤੋਂ ਬਾਅਦ ਉਹਦੇ ਜਦੋਂ ਪੌਦਾ ਲੱਗਦਾ ਉਸਦੇ ਨੇੜੇ ਤੇੜੇ ਸ ਸਫਾਈ ਜ਼ਰੂਰੀ ਹੈ ਉਸਦੀ ਗੁਡਾਈ ਜ਼ਰੂਰੀ ਹੈ ਅਤੇ ਸਮੇਂ ਸਮੇਂ ਸਿਰ ਉਹਦੇ 'ਤੇ ਖਾਦ ਪਾਉਣਾ ਜ਼ਰੂਰੀ ਹੈ ਜਿਵੇਂ ਸਰਦੀਆਂ ਦਾ ਮੌਸਮ ਆਉਂਦਾ ਹੈ ਉਸ ਨੂੰ ਕੋਰੇ ਤੋਂ ਬਚਾਅ ਬਚਾਅ ਕਰਨਾ ਪੈਂਦਾ ਹੈ ਇਸ ਲਈ ਨਾ ਮੌਸਮ ਦੇ ਹਿਸਾਬ ਨਾਲ ਵੀ ਕਈ ਕਿਸਮਾਂ ਵੀ ਸਿਆਲ 'ਚ ਲੱਗ ਕੇ ਜ਼ਿਆਦਾ ਕਾਮਯਾਬ ਰਹਿੰਦੀਆਂ ਨੇ ਕਈ ਕਿਸਮਾਂ ਬਰਸਾਤ 'ਚ ਲਾ ਕੇ ਕਾਮਯਾਬ ਰਹਿੰਦੀਆਂ ਨੇ ਇਸ ਲਈ ਨਾ ਇਹ ਮੌਸਮ 'ਤੇ ਬਹੁਤ ਨਿਰਭਰ ਕਰਦਾ ਹੈ ਵੀ ਕਿਸਮਾਂ 'ਤੇ ਵੀ ਬਹੁਤ ਨਿਰਭਰ ਕਰਦਾ ਹੈ ਵੀ ਕਿਹੜੀ ਕਿਸਮ ਦਾ ਪੌਦਾ ਵੀ ਕਿਹੜੇ ਟਾਈਮ ਲੱਗਣਾ ਚਾਹੀਦਾ ਹੈ ਇਸ 'ਚ ਖਾਦ ਅਤੇ ਬਿਮਾਰੀਆਂ ਤੋਂ ਕਿਵੇਂ ਬਚਾਅ ਹੋ ਸ ਹੋ ਸਕਦਾ ਹੈ ਇਸ ਦਾ ਵੀ ਸਾਨੂੰ ਧਿਆਨ ਰੱਖਣਾ ਪੈਂਦਾ